ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਬੋਲੋ ਜੀ ਬੋਲੋ ਮੈਂ ਹਰਦੀਪ ਸਿੰਘ ਬੋਲ ਰਿਹਾ ਪਲੇਸਮੈਂਟ ਯੂਨਿਟ ਮੈਂਬਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੱਸਾਂਗੇ ਜੀ ਕੀ ਕੀਤਾ ਹੋਇਆ ਤੁਸੀਂ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ ਐਮ ਏ ਇੰਗਲਿਸ਼ ਬੀ ਏ ਵਿੱਚ ਕਿਹੜੇ ਕਿਹੜੇ ਸਬਜੈਕਟ ਸੀ ਓਕੇ ਜੀ ਅਤੇ ਬੀਐਡ ਤੁਸੀਂ ਕਿਹੜੇ ਕੰਬੀਨੇਸ਼ਨ ਨਾਲ ਕੀਤੀ ਹੈ ਐਸ ਐਸ ਟੀ ਇੰਗਲਿਸ਼ ਅੱਗੇ ਪੋਸਟ ਗ੍ਰੈਜੂਏਸ਼ਨ ਇੰਗਲਿਸ਼ ਨਾਲ ਠੀਕ ਹੈ ਹੁਣ ਤੁਹਾਡੀ ਜਿਵੇਂ ਹੁਣ ਤੁਹਾਡੀ ਕੁਆਲੀਫਿਕੇਸ਼ਨ ਤੋਂ ਮੈਨੂੰ ਲੱਗ ਰਿਹਾ ਵੀ ਤੁਸੀਂ ਐਜ ਏ ਟੀਚਰ ਇੰਗਲਿਸ਼ ਦੇ ਜਿਵੇਂ ਜੋਬ ਕਰ ਸਕਦੇ ਹੋ ਹੁਣ ਜਿਵੇਂ ਆਪਣੇ ਪੰਜਾਬ ਸਰਕਾਰ ਬਹੁਤ ਸਾਰੀਆਂ ਓਪਰਚੁਨਟੀਆਂ ਕੱਢ ਰਹੀ ਹੈ ਜਿਵੇਂ ਪਿੱਛੇ ਵੀ ਪੋਸਟਾਂ ਆਈਆਂ ਸੀ ਚਾਰ ਹਜ਼ਾਰ ਉਸ ਤੋਂ ਪਹਿਲਾਂ ਵੀ ਸੈਂਤੀ ਸੌ ਪੋਸਟਾਂ ਆਈਆਂ ਸੀ ਤਾਂ ਤੁਸੀਂ ਉਹਨਾਂ 'ਚ ਅਪਲਾਈ ਕਰ ਸਕਦੇ ਹੋ ਅਤੇ ਆਪਣੇ ਕਰੀਅਰ ਸੁਧਾਰ ਸਕਦੇ ਹੋ ਅਤੇ ਨਿਖਾਰ ਸਕਦੇ ਹੋ ਅਤੇ ਤੁਸੀਂ ਇਹ 'ਚ ਅਪਲਾਈ ਕਰ ਸਕਦੇ ਹੋ ਅੱਛਾ ਹਾਂ ਇਸ ਦੇ ਲਈ ਤੁਹਾਨੂੰ ਓਕੇ ਕੋਈ ਗੱਲ ਨਹੀਂ ਤੁਸੀਂ ਗ੍ਰੈਜੂਏਸ਼ਨ ਤਾਂ ਹੈਗੇ ਹੋ ਗ੍ਰੈਜੂਏਸ਼ਨ ਦੇ ਬੇਸ 'ਤੇ ਹੋਰ ਬਹੁਤ ਸਾਰੀਆਂ ਓਪਰਚੁਨਟੀਆਂ ਕਿਸੇ ਡਿਪਾਰਟਮੈਂਟ 'ਤੇ ਕਲਰਕ ਲੱਗ ਸਕਦੇ ਹੋ ਕਿਸੇ ਵੀ ਹਾਂ ਕਿਸੇ ਵੀ ਮਤਲਬ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾ ਸਕਦੇ ਹੋ ਹਾਂ ਪ੍ਰਾਈਵੇਟ ਸਕੂਲ 'ਚ ਪੜ੍ਹਾ ਸਕਦੇ ਹੋ ਕੋਈ ਵੀ ਕਾਰਪੋਰੇਟ ਅਦਾਰਾ ਪ੍ਰਾਈਵੇਟ ਨਾਲ ਜਾਂ ਸਰਕਾਰੀ ਨਾਲ ਸੰਬੰਧਿਤ ਉਸ ਦੇ ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਅਤੇ ਤੁਸੀਂ ਆਪਣਾ ਸਬਜੈਕਟ ਦੇ ਅਕੋਰਡਿੰਗ ਤੁਸੀਂ ਇੰਡਸਟਰੀਅਲ ਏਰੀਏ ਦੇ ਵਿੱਚ ਜੋਬ ਤਾਂ ਲੈ ਲਓਂਗੇ ਪਰ ਅੱਗੇ ਸਕੋਪ ਨਹੀਂ ਬਣਨਾ ਕੋਈ ਪ੍ਰਮੋਸ਼ਨ ਦਾ ਹਾਂਜੀ ਹੋਰ ਕੁਝ ਦੱਸੋ ਠੀਕ ਹੈ ਜੀ ਠੀਕ ਹੈ ਹੋਰ ਤੁਹਾਨੂੰ ਸਮਝ ਆ ਗਿਆ ਸਾਰਾ ਓਕੇ ਜੀ ਓਕੇ